ਸਕੂਲਾਂ ਦੇ ਵਿੱਚ ਆਮ ਤੌਰ 'ਤੇ ਅੰਗਰੇਜ਼ੀ ਪੰਜਾਬੀ ਹਿੰਦੀ ਤਿੰਨੇ ਭਾਸ਼ਾਵਾਂ ਪੜ੍ਹਾਈਆਂ ਜਾਂਦੀਆ ਹਨ ਇਸ ਤੋਂ ਇਲਾਵਾ ਸਮਾਜਿਕ ਸਿੱਖਿਆ ਵਿਗਿਆਨ ਸਰੀਰਕ ਸਿੱਖਿਆ ਡਰਾਇੰਗ ਆਦਿ ਹੋਰ ਵਿਸ਼ੇ ਵੀ ਕਾਫੀ ਦਿਲਚਸਪੀ ਨਾਲ ਪੜ੍ਹਾਏ ਜਾਂਦੇ ਹਨ ਬੱਚੇ ਇਨ੍ਹਾਂ ਦੇ ਵਿੱਚ ਚੰਗੀ ਰੁਚੀ ਲੈ ਕੇ ਚੰਗੇ ਨੰਬਰ ਪ੍ਰਾਪਤ ਕਰਦੇ ਹਨ ਉਹਨਾਂ ਦੇ ਨਾਲ ਚੰਗੀ ਪ੍ਰਾਪਤੀ ਦੇ ਨਾਲ ਮਾਂ ਬਾਪ ਦਾ ਨਾਂ ਸਕੂਲ ਦਾ ਨਾਂ ਪਿੰਡ ਦਾ ਨਾਂ ਅਤੇ ਸ਼ਹਿਰ ਦਾ ਨਾਂ ਕਾਫ਼ੀ ਅੱਗੇ ਚਲਾ ਜਾਂਦਾ ਹੈ ਅਧਿਆਪਕ ਚੰਗੇ ਪੜ੍ਹੇ ਲਿਖੇ ਹਨ ਉਹਨਾਂ ਦੇ ਕਾਰਨ ਬੱਚੇ ਵੀ ਚੰਗੇ ਪੜ੍ਹ ਲਿਖ ਗਏ ਹਨ